ਸਾਡੇ ਇਲਾਕੇ ਦੇ ਵਿੱਚ ਖਾਸ ਤੌਰ 'ਤੇ ਤਿੰਨ ਜਾਂ ਚਾਰ ਪਾਰਟੀਆਂ ਦੇ ਨੁਮਾਇੰਦੇ ਹੀ ਜ਼ਿਆਦਾ ਪ੍ਰਸਿੱਧ ਹਨ ਇਹਨਾਂ ਮਸ਼ਹੂਰ ਨੇਤਾਵਾਂ ਨੂੰ ਮੋਸਟਲੀ ਸਾਰੇ ਹੀ ਲੋਕ ਜਾਣਦੇ ਨੇ ਕਿਉਂਕਿ ਸ਼ਹਿਰ ਬਹੁਤ ਛੋਟਾ ਏ ਇਸੇ ਤਰੀਕੇ ਦੇ ਨਾਲ ਕਿ ਸ਼ਹਿਰ ਛੋਟਾ ਹੋਣ ਕਰਕੇ ਜਾਂ ਆਪਾਂ ਇਹ ਕਹੀਏ ਕਿ ਉਹਨਾਂ ਦੇ ਵਰਤੋਂ ਵਰਤਾਓ ਸਾਰਿਆਂ ਨਾਲ ਬਹੁਤ ਅੱਛਾ ਹੋਣ ਕਰਕੇ ਜ਼ਿਆਦਾਤਰ ਨੇਤਾ ਦੇ ਨਾਲ ਲੋਕ ਸਿੱਧੇ ਤੌਰ 'ਤੇ ਨਹੀਂ ਤਾਂ ਇੰਡਾਇਰੈਕਟ ਤੌਰ 'ਤੇ ਜੁੜੇ ਹੋਏ ਹੁੰਦੇ ਨੇ ਸਾਨੂੰ ਕਦੇ ਵੀ ਵੈਸੇ ਨੇਤਾਵਾਂ ਦੀ ਜ਼ਰੂਰਤ ਨਹੀਂ ਪਈ ਪਰ ਕਦੇ ਕਦੇ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਕੁਛ ਲੋਕਾਂ ਨੂੰ ਜਦੋਂ ਸਰਕਾਰੀ ਦਫਤਰਾਂ ਦੇ ਵਿੱਚ ਨਜਾਇਜ਼ ਤੌਰ 'ਤੇ ਦੇਰੀ ਕਰਕੇ ਉਹਨਾਂ ਦਾ ਕੰਮ ਲਟਕਾਇਆ ਜਾਂਦਾ ਹੈ ਉਹ ਉਸ ਸਮੇਂ ਇਹਨਾਂ ਨੇਤਾਵਾਂ ਨੂੰ ਭਾਵੇਂ ਉਹ ਜਿਹੜੀ ਵੀ ਪਾਰਟੀ ਹੈਗੀ ਹੈ ਭਾਜਪਾ ਹੈ ਆਪ ਹੈ ਅਕਾਲੀ ਹੈ ਕਾਂਗਰਸ ਹੈ ਜਾਂ ਹੋਰ ਕੋਈ ਵੀ ਛੇਤਰੀ ਜਾਂ ਨੈਸ਼ਨਲ ਲੈਵਲ ਦੀ ਪਾਰਟੀ ਹੈ ਉਹਨਾਂ ਨਾਲ ਜਾ ਕੇ ਗੱਲ ਕਰ ਸਕਦੇ ਹਾਂ